ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਇਤਿਹਾਸਕ ਮੰਦਰ ਹਨ ਜਿਵੇਂ ਕਿ ਸਾਡੇ ਲਾਗਲੇ ਸ਼ਹਿਰ ਕੁਰਾਲੀ ਵਿੱਚ ਮਾਤਾ ਦਾ ਮੰਦਰ ਹੈ ਜੋ ਕਿ ਬਹੁਤ ਹੀ ਪ੍ਰਸਿੱਧ ਹੈ ਉੱਥੇ ਅਲੱਗ ਅਲੱਗ ਧਰਮਾਂ ਦੇ ਲੋਕ ਆਉਂਦੇ ਹਨ ਅਤੇ ਆ ਕੇ ਨਮਸਤਕ ਹੁੰਦੇ ਹਨ ਅਤੇ ਨਾਲ਼ ਹੀ ਇੱਕ ਗਸਾਈਆਂ ਵਾਲ਼ੇ ਵੀ ਮੇਲਾ ਚੱਲਦਾ ਹੈ ਜੋ ਕਿ ਤਿੰਨ ਜਾਂ ਚਾਰ ਦਿਨਾਂ ਦਾ ਹੁੰਦਾ ਹੈ ਜਿਸ ਵਿੱਚ ਕਿ ਅਲੱਗ ਅਲੱਗ ਧਰਮਾਂ ਦੇ ਲੋਕ ਆਉਂਦੇ ਨੇ ਅਤੇ ਆ ਕੇ ਨਮਸਤਕ ਹੁੰਦੇ ਨੇ ਉਹ ਮੇਲੇ ਦੇ ਚਲਦੇ ਹੋਏ ਹੀ ਉੱਥੇ ਭਾਈਚਾਰਕ ਸਾਂਝ ਦਿਖਾਈ ਜਾਂਦੀ ਹੈ ਜਿਸ ਵਿੱਚ ਕਿ ਕੁਸ਼ਤੀਆਂ ਅਤੇ ਹੋਰ ਵੀ ਬਹੁਤ ਚੀਜ਼ਾਂ ਕਰਵਾਈਆਂ ਜਾਂਦੀਆਂ ਹਨ ਜੋ ਕਿ ਭਾਈਚਾਰਕ ਸਾਂਝ ਨੂੰ ਦਖਸ ਦਿਖਾਉਂਦਾ ਹੈ